ਅੱਜ ਦੀਆਂ ਬਦਲਦੀਆਂ ਤਕਨੀਕਾਂ ਤਕਨੀਕੀ ਤਰੱਕੀਆਂ ਨਾਲ ਸਾਨੂੰ ਜੁੜੇ ਰਹਿਣਾ ਹੀ ਪੈਣਾ ਆ ਕਿਉਂਕਿ ਇਹ ਜ਼ਮਾਨਾ ਹੀ ਮੋਬਾਇਲ ਕੰਪਿਊਟਰ ਦਾ ਹੈ ਇਸ ਕਰਕੇ ਸਾਨੂੰ ਇਸ ਦੇ ਨਾਲ ਜੁੜੇ ਰਹਿਣਾ ਪੈਣਾ ਆ ਮੋਬਾਇਲ ਤਾਂ ਮੈਂ ਘਰੇ ਆਪਣੇ ਲੜਕੇ ਕੋਲੋਂ ਹੀ ਸਿੱਖ ਲਿਆ ਸੀ ਔਰ ਕੰਪਿਊਟਰ ਬਾਹਰ ਜਾ ਕੇ ਉੱਥੇ ਸਿੱਖਣਾ ਪਿਆ ਮੈਨੂੰ